ਹੈਲੋ ਗੁਡ ਮੋਰਨਿੰਗ ਸਰ ਸਰ ਪਲੇਸਮੈਂਟ ਸੈਲ ਸੇ ਬੋਲ ਰਹੇ ਹੋ ਅਤੇ ਸਰ ਮੈਂ ਵੰਸ਼ ਗੱਲ ਕਰ ਰਿਹਾਂ ਸਰ ਅ ਕੁ ਅ ਯੂਨੀਵਰਸਿਟੀ ਪੜ੍ਹਦਾ ਐਂ ਗੁਰਦਾਸਪੁਰ ਯੂਨੀਵਰਸਿਟੀ 'ਚ ਹਾਂਜੀ ਸਰ ਅਤੇ ਮੈਂ ਬੀਟੈਕ ਆਪਣੀ ਪੂਰੀ ਕੀਤੀ ਮਕੈਨੀਕਲ ਇੰਜੀਨੀਅਰਿੰਗ ਵਿੱਚ ਵਿਦ ਏਟ ਐਂਡ ਹਾਫ ਸੀ ਜੀ ਪੀ ਹੈ ਹਾਂਜੀ ਅਤੇ ਸਰ ਮੈਂ ਨਾ ਜੋਬ ਵੀ ਸਰ ਮੈਂ ਜੋਬ ਓਪਚੂਨਿਟੀਸ ਵੇਖਣਾ ਚਾਹੁੰਦਾ ਕਿ ਇੱਥੇ ਕਿ ਕਿਸ ਕਿਸ ਚੀਜ਼ 'ਚ ਪਲੇਸਮੈਂਟ ਹੋ ਸਕਦੀ ਹੈ ਸਰ ਮੇਰੀ ਮੇਰੀ ਫੀਲਡ ਦੇ ਮਤਲਬ ਅਕੋਰਡਿੰਗ ਹੋਵੇ ਹਾਂਜੀ ਅੱਛਾ ਅੱਛਾ ਜੀ ਹਾਂਜੀ ਜੀ ਹਾਂ ਸਰ ਕੋਈ ਨਾ ਮੈਂ ਕਰ ਦੂੰਗਾ ਰਿਜ਼ੀਊਮੇ ਸੈਂਡ ਅਤੇ ਸਰ ਗੌਰਮੈਂਟ ਰਿਲੇਟਿਡ ਕੋਈ ਮਤਲਬ ਨਹੀਂ ਨਿਕਲੀ ਪੋਸਟ ਹਜੇ ਇੱਥੇ ਅੱਛਾ ਅੱਛਾ ਅੱਛਾ ਅੱਛਾ ਅਤੇ ਸਰ ਮੈਂ ਤੁਹਾਨੂੰ ਫਿਰ ਰਿਜ਼ੀਊਮੇ ਸੈਂਡ ਕਰ ਦਿੰਨਾ ਇਸੇ ਨੰਬਰ 'ਤੇ ਕਰਨਾ ਸੈਂਡ ਕੋਈ ਨਾ ਸਰ ਓਕੇ ਥੈਂਕਯੂ ਸਰ